ਜੀ ਹਾਂ ਮੈਂ ਯਾਤਰਾ ਦੌਰਾਨ ਬੜੇ ਤਰ੍ਹਾਂ ਦੇ ਸੱਭਿਆਚਾਰਕ ਝਟਕਿਆਂ ਦਾ ਅਨੁਭਵ ਕੀਤਾ ਹੈ ਮੈਂ ਜਿਵੇਂ ਕਿ ਵ੍ਰਿੰਦਾਵਨ ਗਈ ਹਾਂ ਵ੍ਰਿੰਦਾਵਨ ਦੇ ਵਿੱਚ ਬੜੇ ਤਰ੍ਹਾਂ ਦੇ ਲੋਕ ਆਉਂਦੇ ਹਨ ਉੱਥੇ ਆਪਣਾ ਜਿਹੜਾ ਸਾਡਾ ਸੱਭਿਆਚਾਰ ਹੈ ਉੱਥੇ ਹੋਰ ਵੀ ਵੱਖ ਵੱਖ ਪ੍ਰਾਂਤਾਂ ਦੇ ਲੋਕ ਆਉਂਦੇ ਹਨ ਜਿਹਦੇ ਵਿੱਚ ਕਿ ਮੈਨੂੰ ਉਹਨਾਂ ਦੇ ਸੱਭਿਆਚਾਰ ਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਫਿਰ ਵੀ ਅਸੀਂ ਉਹਨਾਂ ਨੂੰ ਆਪਣਾ ਭਗਵਾਨ ਕ੍ਰਿਸ਼ਨ ਦਾ ਅਤੇ ਰਾਧਾ ਰਾਣੀ ਦਾ ਨਾਂ ਲੈ ਕੇ ਸੰਭਾਲ ਲੈਂਦੇ ਹਾਂ ਫਿਰ ਮੈਂ ਇਸ ਤੋਂ ਇਲਾਵਾ ਚਿੰਤਪੁਰਨੀ ਮਾਤਾ ਦੇ ਮੰਦਿਰ ਵੀ ਜਾਂਦੀ ਹਾਂ ਜਿੱਥੇ ਕਿ ਚਿੰਤਪੁਰਨੀ ਜਿਹਦਾ ਕਿ ਆਪਣਾ ਹਿਮਾਚਲ ਦੇ ਵਿੱਚ ਹੈਗਾ ਹੈ ਉੱਥੇ ਵੀ ਬੜੇ ਤਰ੍ਹਾਂ ਦੇ ਲੋਕ ਆਉਂਦੇ ਹਨ ਉੱਥੇ ਵੀ ਆਪਾਂ ਨੂੰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਇੱਕ ਦੂਸਰੇ ਦੀ ਭਾਸ਼ਾ ਸਮਝ 'ਚ ਨਹੀਂ ਆਉਂਦੀ ਕਈ ਵਾਰੀ ਉਹਨਾਂ ਦਾ ਕਲਚਰ ਅਲੱਗ ਹੁੰਦਾ ਹੈ ਅਤੇ ਜਾਂ ਕਈ ਵਾਰ ਉਹਨਾਂ ਦਾ ਪਹਿਰਾਵਾ ਜਾਂ ਸਾਡਾ ਪਹਿਰਾਵਾ ਅਲੱਗ ਅਲੱਗ ਹੁੰਦਾ ਸਾਡਾ ਸੱਭਿਆਚਾਰਿਕ ਦੂਸਰੇ ਨਾਲ ਕਦੇ ਵੀ ਮੈਚ ਨਹੀਂ ਹੁੰਦਾ ਤਾਂ ਫਿਰ ਵੀ ਫਿਰ ਆਪਾਂ ਫਿਰ ਵੀ ਆਪਾਂ ਇੱਕ ਦੂਸਰੇ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਪਾਂ ਮਤਲਬ ਕਿ ਉਹਨਾਂ ਨੂੰ ਸਮਝ ਸਕੀਏ ਤਾਂ ਕਿ ਉਹਨਾਂ ਨੂੰ ਉਹ ਵੀ ਸਾਡੀ ਤਰ੍ਹਾਂ ਸਾਡੇ ਤੋਂ ਕਿਸੇ ਤਰ੍ਹਾਂ ਦੇ ਨਾਲ ਮਤਲਬ ਕਿ ਇਰੀਟੇਟ ਨਾ ਹੋਣ ਅਤੇ ਉਹ ਵੀ ਸਾਡੇ ਤੋਂ ਨਾ ਹੋਣ ਅਸੀਂ ਵੀ ਉਹਨਾਂ ਤੋਂ ਨਾ ਕਿਸੇ ਤਰੀਕੇ ਮਤਲਬ ਸਾਨੂੰ ਵੀ ਥੋੜ੍ਹਾ ਮਤਲਬ ਕਿ ਨਾ ਆਪਣਾ ਇਰੀਟੇਟ ਹੋਣਾ ਪਵੇ ਤਾਂ ਕਿ ਸ ਸਾਨੂੰ ਦੋਨਾਂ ਨੂੰ ਇੱਕ ਆਪਣਾ ਆਪਣਾ ਮਤਲਬ ਕਲਚਰ ਜਾਂ ਆਪਣਾ ਆਪਣਾ ਸੱਭਿਆਚਾਰ ਸਾਨੂੰ ਦੋਨਾਂ ਨੂੰ ਸਮਝ ਲੱਗ ਜਾਵੇ ਅਤੇ ਮੈਂ ਇਹ ਹੀ ਚਾਹੁੰਦੀ ਹਾਂ ਮੈਂ ਇਹਨੂੰ